ਅਸੀਂ ਗਰਮੀਆਂ ਦੇ ਮੌਸਮ ਦੇ ਵਿੱਚ ਘੁੰਮਣਾ ਪਸੰਦ ਕਰਦੇ ਹਾਂ ਜਿਵੇਂ ਕਿ ਹੇਮਕੁੰਟ ਸਾਹਿਬ ਗਰਮੀਆਂ ਦੇ ਵਿੱਚ ਖੁੱਲਦਾ ਹੈ ਉੱਥੇ ਗਰਮੀਆਂ ਦੇ ਵਿੱਚ ਠੰਡ ਹੁੰਦੀ ਹੈ ਅਤੇ ਉੱਥੇ ਜਾਣਾ ਅਸੀਂ ਬਹੁਤ ਪਸੰਦ ਕਰਦੇ ਹਾਂ ਜਿਵੇਂ ਕਿ ਮਨੀਕਰਨ ਸਾਹਿਬ ਹੋਇਆ ਉੱਥੇ ਵੀ ਠੰਡ ਪੈਂਦੀ ਹੈ ਉੱਥੇ ਵੀ ਅਸੀਂ ਗਰਮੀਆਂ ਦੇ ਵਿੱਚ ਘੁੰਮਣਾ ਪਸੰਦ ਕਰਦੇ ਹਨ ਅਤੇ ਸ਼ਿਮਲਾ ਦੇ ਵਿੱਚ ਵੀ ਗਰਮੀਆਂ ਦੇ ਵਿੱਚ ਠੰਡ ਹੁੰਦੀ ਹੈ ਉੱਥੇ ਜਾਣਾ ਵੀ ਅਸੀਂ ਗਰਮੀਆਂ 'ਚ ਘੁੰਮਣਾ ਪਸੰਦ ਕਰਦੇ ਹਨ ਅਤੇ ਹੋਰ ਵੀ ਕਈ ਥਾਵਾਂ ਇਹੋ ਜਿਹੀਆਂ ਹਨ ਜਿੱਥੇ ਠੰਡ ਹੁੰਦੀ ਹੈ ਅਤੇ ਗਰਮੀਆਂ ਦੇ ਵਿੱਚ ਜਾਣਾ ਪਸੰਦ ਕਰਦੇ ਹਨ